ਹੈਲੋ ਹਾਂਜੀ ਕੁਲਵਿੰਦਰ ਸਰ ਕਿਵੇਂ ਹੋ ਵਧੀਆ ਠੀਕ ਠਾਕ ਹੋਰ ਵਧੀਆ ਸਰ ਵਧੀਆ ਵਧੀਆ ਅਤੇ ਤੁਹਾਨੂੰ ਪਤਾ ਹੀ ਆ ਵੀ ਮੇਰੀ ਟਰਾਂਸਫਰ ਹੋ ਚੁੱਕੀ ਆ ਸ਼੍ਰੀ ਮੁਕਤਸਰ ਸਾਹਿਬ ਹਾਂਜੀ ਹੁਣ ਮੈਂ ਇੱਥੋਂ ਮਤਲਬ ਹਿਮਾਚਲ ਤੋਂ ਆਉਣਾ ਏ ਅਤੇ ਸਰ ਹਾਂਜੀ ਅਤੇ ਅਗਲੇ ਮਹੀਨੇ ਮੈਂ ਜੁਆਇਨ ਕਰ ਰਹੀ ਹਾਂ ਇੱਥੇ ਅਤੇ ਆਲਮੋਸਟ ਤਾਂ ਸਰ ਮੇਰੀ ਸ਼ੋਪਿੰਗ ਇਥੋਂ ਹੋ ਹੀ ਗਈ ਆ ਅਤੇ ਪਰ ਮਤਲਬ ਕੁਝ ਤਾਂ ਮੇਰਾ ਮਤਲਬ ਜਿਵੇਂ ਸਰਦੀ ਵਾਲੇ ਕਸਟਮ ਆ ਸਵੈਟਰ ਵਗੈਰਾ ਜਾਂ ਸ਼ੋਲ ਵਗੈਰਾ ਰਹਿ ਗਏ ਅਤੇ ਮੈਂ ਇਹ ਸਾਰੀ ਸ਼ੋਪਿੰਗ ਸ਼੍ਰੀ ਮੁਕਤਸਰ ਸਾਹਿਬ ਤੋਂ ਕਰਨੀ ਆ ਅਤੇ ਹਾਂਜੀ ਤੁਸੀਂ ਇਹਦੇ ਵਿੱਚ ਮੇਰੀ ਹੈਲਪ ਕਰਨੀ ਅਤੇ ਇੱਕ ਤਾਂ ਤੁਸੀਂ ਮੈਨੂੰ ਇਹ ਦੱਸੋ ਵੀ ਮਤਲਬ ਇੱਧਰਲਾ ਇਨਵਾਰਨਮੈਂਟ ਕਿੱਦਾਂ ਦਾ ਹਾਂਜੀ ਹਾਂਜੀ

ਹਾਂਜੀ ਹਾਂਜੀ ਅੱਛਾ ਜੀ ਠੀਕ ਹੈ ਅੱਛਾ ਜੀ ਜਾਣੀ ਕਿ ਬੈਸਟ ਕੁਆਲਟੀ ਮਿਲਦੀ ਆ ਉੱਥੇ ਹਾਂਜੀ ਹਮ ਅੱਛਾ ਅੱਛਾ ਠੀਕ ਹੈ ਅਤੇ ਸਰ ਇੱਥੇ ਹਾਂਜੀ ਇੱਥੇ ਇਸ ਸਾਈਡ 'ਤੇ ਮਤਲਬ ਜਿਵੇਂ ਘਰ ਵੀ ਲੇਡੀਜ ਬਣਾਉਂਦੀਆਂ ਨੇ ਸਵੈਟਰ ਕੋਟੀ ਵਗੈਰਾ ਅੱਛਾ ਜੀ ਹਾਂਜੀ ਅੱਛਾ ਜੀ ਅੱਛਾ ਅੱਛਾ ਠੀਕ ਹੈ ਯਾਨੀ ਕਿ ਲੇਡੀਜ਼ ਇਹ ਕੰਮ ਘਰ ਵੀ ਕਰਦੀਆਂ ਨੇ ਅੱਛਾ ਹਾਂਜੀ ਠੀਕ ਹੈ ਅਤੇ ਬਾਕੀ ਜਿਹੜਾ ਆਪਾਂ ਮੋਲ 'ਚੋਂ ਵੀ ਖਰੀਦਦੇ ਹਾਂ ਵੀ ਉਹ ਵੀ ਬੈਸਟ ਚੀਜ਼ ਮਿਲਦੀ ਹੈ ਨਾ ਹਾਂਜੀ ਇਹ ਤਾਂ ਹੈ ਸਰ ਹਾਂਜੀ ਠੀਕ ਹੈ ਅਤੇ ਹਾਂਜੀ ਚਲੋ ਕੋਈ ਗੱਲ ਨਹੀਂ ਮੈਂ ਵੈਸੇ ਆ ਰਹੀ ਹਾਂ ਥੋੜ੍ਹੇ ਦਿਨਾਂ ਲਈ ਅਤੇ ਫਿਰ ਨੇਕਸਟ ਮੰਥ ਇੱਥੋਂ ਵਿਸ਼ਾਲ ਮੋਲ 'ਚੋਂ ਹੀ ਸ਼ੋਪਿੰਗ ਕਰ ਲਵਾਂਗੇ ਅਤੇ ਨਾਲੇ ਉਦੋਂ ਤੱਕ ਮੌਸਮ ਚੇਂਜ ਹੋ ਜਾਵੇਗਾ ਫਰਕ ਪੈ ਜਾਵੇਗਾ ਹਾਂਜੀ ਅਤੇ ਬਾਕੀ ਹਾਂਜੀ ਹਾਂਜੀ ਅੱਛਾ ਐਵੇਂ ਦਾ ਮੌਸਮ ਹੈ ਠੀਕ ਹੈ ਕੋਈ ਗੱਲ ਨਹੀਂ ਸਰ ਕਰਦੇ ਹਾਂ ਵਿਜ਼ਿਟ ਥੋੜ੍ਹੇ ਜਿਹੇ ਦਿਨ ਤੱਕ ਓਕੇ ਜੀ ਓਕੇ ਥੈਂਕ ਯੂ ਓਕੇ